ਹੈਲੋ ਸਰ ਮੀਸਾ ਕੰਪਨੀ ਤੋਂ ਬੋਲ ਰਹੇ ਹੋ ਹਾਂ ਇਹ ਅਸੀਂ ਤੁਹਾਡੇ ਤੋਂ ਪਹਿਲਾਂ ਪ੍ਰੋਡਕਟ ਮੰਗਵਾਇਆ ਸੀ ਉਹ ਤਾਂ ਬਿਲਕੁਲ ਠੀਕ ਸੀ ਇਸ ਵਾਰ ਤੁਹਾਡੇ ਕੋਲ ਅਸੀਂ ਗੀਜ਼ਰ ਮੰਗਵਾਇਆ ਸੀ ਗੀਜ਼ਰ ਐਲ ਐੱਲ ਏ ਜੀ ਦਾ ਮੰਗਵਾਇਆ ਸੀ ਉਹ ਤੁਸੀਂ ਕੁਝ ਹੋਰ ਕੰਪਨੀ ਦਾ ਭੇਜ ਦਿੱਤਾ ਇੱਕ ਕਲਰ ਅਸੀਂ ਤੁਹਾਡੇ ਕੋਲ ਵਾਈਟ ਨਹੀਂ ਸੀ ਮੰਗਵਾਇਆ ਕਲਰ ਬਰਾਊਨ ਮੰਗਵਾਇਆ ਸੀ ਤੁਸੀਂ ਵਾਈਟ ਭੇਜ ਦਿੱਤਾ ਵਾਈਟ ਕਲਰ ਨਹੀਂ ਸਹੀ ਲੱਗਦਾ ਸਾਡੇ ਬਾਥਰੂਮ ਦੀਆਂ ਪਲੇਟਾਂ ਬਰਾਊਨ ਕਲਰ ਦੀਆਂ ਨੇ ਅਤੇ ਉਹ ਬਰਾਊਨ ਕਲਰ ਦੇ ਵਿੱਚ ਵਾਈਟ ਕਲਰ ਨਹੀਂ ਸਹੀ ਲੱਗਦਾ ਇੱਕ ਪਾਣੀ ਇੰਨੀ ਜਲਦੀ ਗਰਮ ਨਹੀਂ ਕਰਦਾ ਬਹੁਤ ਵੇਟ ਕਰਨੀ ਪੈਂਦੀ ਹੈ ਪਾਣੀ ਨਹੀਂ ਜਲਦੀ ਗਰਮ ਹੁੰਦਾ ਅਤੇ ਇਹ ਪ੍ਰੋਡਕਟ ਜਿਹੜਾ ਹੈ ਤੁਹਾਡਾ ਬਿਲਕੁਲ ਨਹੀਂ ਸਹੀ ਤੁਸੀਂ ਇਹ ਵਾਪਸ ਕਰਨਾ ਹੈ ਅਸੀਂ ਤੁਹਾਨੂੰ ਅਤੇ ਜੋ ਵੀ ਅੱਗੇ ਤੋਂ ਮੰਗਵਾਵੇ ਕੋਈ ਕਸਟਮਰ ਉਹੀ ਤੁਸੀਂ ਭੇਜੋ ਨਹੀਂ ਤਾਂ ਇਸ ਤਰ੍ਹਾਂ ਕਿਸੇ ਨੂੰ ਪ੍ਰੋਡਕਟ ਨਹੀਂ ਭੇਜਣਾ ਚਾਹੀਦਾ ਅਤੇ ਇੱਕ ਜੋ ਤੁਹਾਡੇ ਕੋਲ ਕਲਰ ਮੰਗਵਾਇਆ ਹੋਵੇ ਉਹ ਹੀ ਕਲਰ ਭੇਜੋ ਠੀਕ ਹੈ ਅਤੇ ਨਾ ਹੀ ਇਸ ਤਰ੍ਹਾਂ ਕਿਸੇ ਨੂੰ ਪਰੇਸ਼ਾਨੀ ਆਉਂਦੀ ਹੈ ਫਿਰ ਦੁਬਾਰਾ ਕਿਸ ਵੇਲੇ ਕਿਸੀ ਕੋਲ ਟਾਈਮ ਨਹੀਂ ਹੁੰਦਾ ਦੁਬਾਰਾ ਇਸ ਤਰ੍ਹਾਂ ਨਾ ਕਰੋ ਠੀਕ ਹੈ ਅਤੇ ਪਲੀਜ਼ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੇ ਕਸਟਮਰ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਓਕੇ